ਬਾਈਕਿੰਗ ਸ਼ੁਰੂ ਕਰਨ ਦੀ ਪ੍ਰੇਰਨਾ ਉਕਸੁਕਤਾ ਸਾਹਸ ਅਤੇ ਦੋ ਪਹੀਆਂ ਵਾਲੀ ਆਜ਼ਾਦੀ ਲਈ ਪ੍ਰਸ਼ੰਸਾ ਦੇ ਮਿਸ਼ਰਣ ਤੋਂ ਆਈ ਹੈ ਮੈਨੂੰ ਯਾਦ ਹੈ ਕਿ ਮੈਂ ਹਾਈਵੇ ਦੇ ਬਾਈਕਰਾਂ ਨੂੰ ਦੇਖਦਾ ਸੀ ਉਹਨਾਂ ਦੀਆਂ ਮਸ਼ੀਨਾਂ ਹਵਾ ਵਿੱਚੋਂ ਲੰਘਦੇ ਹੋਏ ਗਰਜਦੀਆਂ ਸਨ ਅਤੇ ਮੈਨੂੰ ਰੋਜ਼ਾਨਾ ਜੀਵਨ ਦੀ ਰੂਟੀਨ ਤੋਂ ਦੂਰ ਖੁੱਲ੍ਹੀ ਸੜਕ 'ਤੇ ਹੋਣ ਦੇ ਵਿਚਾਰ ਤੋਂ ਆਕਰਸ਼ਿਤ ਹੋ ਗਿਆ ਸੀ ਉਹ ਤਸਵੀਰ ਮੇਰੇ ਨਾਲ ਜੁੜ ਗਈ ਅਤੇ ਮੈਨੂੰ ਪਤਾ ਸੀ ਕਿ ਮੈਨੂੰ ਇਸ ਨੂੰ ਆਪਣੇ ਲਈ ਅਨੁਭਵ ਕਰਨਾ ਪਵੇਗਾ ਮੇਰੀ ਯਾਤਰਾ ਇੱਕ ਸਧਾਰਨ ਸਾਈਕਲ ਨਾਲ ਸ਼ੁਰੂ ਹੋਈ ਸੀ ਅਤੇ ਪਹਿਲਾਂ ਇਹ ਇਹ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਬਾਰੇ ਸੀ ਪਰ ਹਰ ਸਵਾਰੀ ਦੇ ਨਾਲ ਮੈਂ ਸੜਕ ਨਾਲ ਡੂੰਘਾ ਸੰਬੰਧ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਪਹਿਲੀ ਵਾਰ ਜਦੋਂ ਮੈਂ ਹਾਈਵੇ 'ਤੇ ਇੱਕ ਖਾਲੀ ਹਿੱਸੇ ਦੇ ਇਕੱਲੇ ਸਵਾਰੀ ਕੀਤੀ ਆਪਣੇ ਚਿਹਰੇ ਦੇ ਵਿਰੁੱਧ ਹਵਾ ਅਤੇ ਇੰਜਨ ਦੀ ਤਾਲਬੁਧ ਗੂੰਜ ਨੂੰ ਮਹਿਸੂਸ ਕੀਤਾ ਤਾਂ ਮੈਨੂੰ ਅਹਿਸਾਸ ਹੋਇਆ ਕਿ ਸਾਈਕਲ ਚਲਾਉਣਾ ਸਿਰਫ ਆਵਾਜਾਈ ਤੋਂ ਵੱਧ ਸੀ ਇਹ ਸ਼ੁੱਧ ਆਜ਼ਾਦੀ ਦੀ ਭਾਵਨਾ ਸੀ ਜਿਵੇਂ ਜਿਵੇਂ ਮੈਂ ਬੀਤਦੇ ਸਾਲ ਬੀਤਦੇ ਗਏ ਸਾਈਕਲ ਚਲਾਉਣ ਦਾ ਮੇਰਾ ਜਨੂੰਨ ਹੋਰ ਵੀ ਮਜ਼ਬੂਤ ਹੋ ਗਿਆ ਮੈਂ ਲੰਮੀਆਂ ਸਵਾਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਜਿਵੇਂ ਨਵੇਂ ਖੇਤਰਾਂ ਦੀ ਪੜਚੋਲ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਵੱਖ ਵੱਖ ਸਵਾਰੀਆਂ ਸ਼ੈਲੀਆਂ ਨਾਲ ਆਪਣੇ ਆਪ ਨੂੰ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ ਸੀ ਮੈਂ ਪਹਾੜੀ ਸੜਕਾਂ ਹਾਈਵੇ ਅਤੇ ਓਫਰੋ ਟਰੇਲਾਂ ਵਿੱਚ ਉੱਦਮ ਕੀਤਾ ਹਰ ਸਵਾਰੀ ਮੈਨੂੰ ਕੁਝ ਨਵਾਂ ਸਿਖਾ ਰਹੀ ਸੀ ਬਾਈਕਿੰਗ ਸਿਰਫ ਗਤੀ ਬਾਰੇ ਨਹੀਂ ਸੀ ਇਹ ਧੀਰਜ ਧੀਰਜ ਅਤੇ ਬਦਲਦੇ ਰਸਤੇ ਦੇ ਅਨੁਕੂਲ ਹੋਣ ਦੀ ਯੋਗਤਾ ਬਾਰੇ ਸੀ ਮੇਰੀ ਸਾਈਕਲਿੰਗ ਯਾਤਰਾ ਵਿੱਚ ਸਭ ਤੋਂ ਮਹੱਤਵਪੂਰਨ ਮੋੜਾਂ ਵਿੱਚੋਂ ਇੱਕ ਹੋਰ ਜੋਸ਼ੀਲੇ ਸਵਾਰਾਂ ਨੂੰ ਮਿਲਣਾ ਸੀ ਇੱਕ ਸਾਈਕਲਿੰਗ ਭਾਈਚਾਰੇ ਦਾ ਹਿੱਸਾ ਹੋਣ ਨੇ ਮੇਰੇ ਲਈ ਇੱਕ ਪੂਰੀ ਨਵੀਂ ਦੁਨੀਆਂ ਖੋਲ੍ਹ ਦਿੱਤੀ ਸੀ ਮੈਂ ਉਹਨਾਂ ਦੀਆਂ ਕਹਾਣੀਆਂ ਸੁਣੀਆਂ ਵੱਖ ਵੱਖ ਸਾਈਕਲਾਂ ਬਾਰੇ ਸਿੱਖਿਆ ਅਤੇ ਸ ਸਵਾਰੀ ਦੇ ਡੂੰਘੇ ਫਸਲਫਸੇ ਨੂੰ ਸਮਝਿਆ ਇਹ ਸਿਰਫ ਇੱਕ ਮੰਜ਼ਿਲ ਦੇ ਪਹੁੰਚਣ ਬਾਰੇ ਨਹੀਂ ਸੀ ਸਗੋਂ ਯਾਤਰਾ ਦੇ ਹਰ ਪਲ ਨਾਲ ਆਨੰਦ ਲੈਣ ਬਾਰੇ ਸੀ ਧੰਨਵਾਦ